ਗਿਆਰਾਂ ਮਾਰਚ ਉੱਨੀ ਸੌ ਬੱਨਵੇ ਨੌ ਜੂਨ ਉੱਨੀ ਸੌ ਚਰੱਨਵੇ ਪੰਦਰਾਂ ਅਗਸਤ ਉੱਨੀ ਸੌ ਅਠੱਨਵੇ ਤੇਰਾਂ ਅਕਤੂਬਰ ਉੱਨੀ ਸੌ ਨੜਿੱਨਵੇ ਵੀਹ ਨਵੰਬਰ ਦੋ ਹਜ਼ਾਰ ਦੋ